ਭਾਰਤ ਵਿੱਚ ਮੇਰੇ ਮਨ ਪਸੰਦ ਰਾਜ ਰਾਜ ਹੈ ਕਸ਼ਮੀਰ ਕਿਉਂਕਿ ਉੱਥੋਂ ਦਾ ਜੋ ਵਾਤਾਵਰਨ ਹੈ ਬਹੁਤ ਹੀ ਜ਼ਿਆਦਾ ਸਾਫ ਸੁਥਰਾ ਹੈ ਉੱਥੋਂ ਦਾ ਪਾਣੀ ਉੱਥੋਂ ਦੇ ਜੋ ਫਲ ਹਨ ਖਾਣ ਪੀਣ ਦਾ ਸਮਾਨ ਉਹ ਬਹੁਤ ਹੀ ਜ਼ਿਆਦਾ ਸਾਫ ਸੁਥਰਾ ਅਤੇ ਵਧੀਆ ਮਿਲਦਾ ਹੈ ਅਤੇ ਮੈਨੂੰ ਸਭ ਤੋਂ ਵਧੀਆ ਭਾਰਤ ਦਾ ਜੋ ਕਸ਼ਮੀਰ ਰਾਜ ਹੈ ਬਹੁਤ ਹੀ ਜੰਮੂ ਅਤੇ ਕਸ਼ਮੀਰ ਬਹੁਤ ਹੀ ਸੋਹਣਾ ਅਤੇ ਵਧੀਆ ਲੱਗਦਾ ਹੈ ਇਸ ਕਰਕੇ ਮੈਂ ਉੱਥੇ ਘੁੰਮਣਾ ਚਾਹਵਾਂਗਾ ਕਿਉਂਕਿ ਉੱਥੋਂ ਦੇ ਲੋਕ ਵੀ ਬਹੁਤ ਹੀ ਸਾਦਗੀ ਭਰੇ ਹਨ ਅਤੇ ਚੰਗੇ ਸੁਭਾਅ ਦੇ ਹਨ ਉੱਥੋਂ ਦਾ ਜੋ ਵਾਤਾਵਰਨ ਹੈ ਉੱਥੋਂ ਦੀ ਬਣਤਰ ਹੈ ਉਹ ਵੀ ਸਾਡੇ ਦਿਲ ਨੂੰ ਸ਼ਾਂਤੀ ਦਿੰਦੀ ਹੈ ਬਹੁਤ ਹੀ ਸ਼ਾਂਤੀ ਵਾਲਾ ਸ਼ਾਂਤੀ ਵਾਲੀ ਜਗ੍ਹਾ ਹੈ ਉੱਥੇ ਪਹੁੰਚ ਕੇ ਦਿਲ ਨੂੰ ਸ਼ਾਂਤੀ ਮਿਲਦੀ ਹੈ ਅਤੇ ਮਨਮੋਹਕ ਦ੍ਰਿਸ਼ ਜੋ ਉੱਥੋਂ ਦੇ ਹਨ ਉਹਨਾਂ ਨੂੰ ਦੇਖ ਕੇ ਬੰਦਾ ਖੁਸ਼ ਹੁੰਦਾ ਹੈ ਕਸ਼ਮੀਰ ਦੇ ਜੋ ਪਹਾੜੀਆਂ ਹਨ ਉੱਥੋਂ ਦੀ ਜੋ ਸੁੰਦਰਤਾ ਹੈ ਉਸ ਦੀ ਕੋਈ ਵੀ ਰੀਸ ਨਹੀਂ ਉਹਨਾਂ ਨੂੰ ਦੇਖ ਕੇ ਮਨ ਮਨ ਨੂੰ ਮਨੋ ਚਾਅ ਨਿਕਲਦੇ ਹਨ ਅਤੇ ਮੈਨੂੰ ਸਭ ਤੋਂ ਸੋਹਣਾ ਕਸ਼ਮੀਰ ਰਾਜ ਲੱਗਦਾ ਹੈ ਅਤੇ ਮੈਂ ਉੱਥੇ ਘੁੰਮਣਾ ਚਾਹਵਾਂਗਾ